ਹਾਂਜੀ ਹੈਲੋ ਨਮਸਕਾਰ ਜੀ ਹਾਂਜੀ ਉਹ ਨਾ ਸਾਡੇ ਇੱਥੇ ਇੱਕ ਮੁੰਡਾ ਹੈ ਉਹ ਨਸ਼ੇ ਪੱਤੇ ਉਹ ਨਸ਼ੇ ਪੱਤੀਆਂ ਬੜੀਆਂ ਕਰਦਾ ਹੈ ਟੀਕੇ ਲਗਾਉਂਦੇ ਆ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਅੱਛਾ ਜੀ

ਠੀਕ ਹੈ ਜੀ

ਠੀਕ ਆ ਠੀਕ ਆ ਜੀ ਨਹੀਂ ਮੈਂ ਨਹੀਂ ਆਪਣਾ ਇਹ ਇਹ ਦੀ ਜਗ੍ਹਾ ਉਹਦਾ ਠੀਕ ਹੈ